ਹੈਲੋ ਸਤਿ ਸ਼੍ਰੀ ਅਕਾਲ ਸੁਖਬੀਰ ਜੀ ਮੈਂਮ ਬੋਲ ਰਹੇ ਆ ਮੈਂ ਮੈਂ ਸ੍ਰਿਸ਼ਟੀ ਦੀ ਮੰਮਾ ਬੋਲ ਰਹੀ ਹਾਂ ਮੈਮ ਅਸੀਂ ਨਾ ਇੱਕ ਮੈਰਿਜ 'ਚ ਜਾਣਾ ਸੀ ਮੇਰੇ ਬਰਦਰ ਦੀ ਮੈਰਿਜ ਹੈ ਚੰਡੀਗੜ੍ਹ ਅਤੇ ਸਾਨੂੰ ਸੱਤ ਦਿਨ ਦੀ ਲੀਵ ਚਾਹੀਦੀ ਓਕੇ ਤਿੰਨ ਦਿਨਾਂ ਦੀ ਛੁੱਟੀ ਮਿਲ ਸਕਦੀ ਹੈ ਦੋ ਦਿਨ ਦੀ ਬਟ ਸਾਨੂੰ ਮੈਕਸੀਮਮ ਤਿੰਨ ਦਿਨ ਤਾਂ ਫਿਰ ਵੀ ਚਾਹੀਦੀ ਨੇ ਚੰਡੀਗੜ੍ਹ ਆਉਣ ਜਾਣ ਵਾਸਤੇ ਚਲੋ ਠੀਕ ਆ ਮੈਂ ਫਿਰ ਵੇਖਦੀ ਹਾਂ ਥੈਂਕ ਯੂ ਹਾਂਜੀ ਥੈਂਕ ਯੂ